ਦੇਖ ਪਹਿਲਾਂ ਤਾਂ ਮੈਨੂੰ ਤੂੰ ਆਪਣੀ ਰਿਕੁਆਇਰਮੈਂਟ ਦੱਸ ਦੇ ਤੇਰੀ ਰਿਕੁਆਇਰਮੈਂਟ ਹੈ ਕਿਆ ਤੈਨੂੰ ਕਿੰਨੇ ਕੁ ਰੁਪਏ ਤੂੰ ਲਗਾ ਸਕਦਾ ਹੈ ਆਪਣੀ ਏਜ ਦੱਸ ਤੇਰੀ ਏਜ ਦੇ ਹਿਸਾਬ ਨਾਲ ਮੈਂ ਤੇਰਾ ਫਿਰ ਦੱਸੂਗਾ ਤੈਨੂੰ ਕਿਹੜੀ ਇਨਸ਼ੋਰੈਂਸ ਲੈਣੀ ਚਾਹੀਦੀ ਹੈ ਜਾਂ ਕਿਹੜੀ ਨਹੀਂ ਲੈਣੀ ਚਾਹੀਦੀ ਬਜ਼ਾਰ ਦੇ ਵਿੱਚ ਬਹੁਤ ਕੰਪਨੀਆਂ ਨੇ ਜੋ ਬੀਮਾ ਇਨਸ਼ੋਰੈਂਸ ਵੇਚਦੀਆਂ ਨੇ ਪਰ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਐੱਲ ਆਈ ਸੀ ਜਿਹੜੀ ਹੈ ਸਭ ਤੋਂ ਪੁਰਾਣੀ ਹੈ ਅਤੇ ਸਭ ਤੋਂ ਭਰੋਸੇਮੰਦ ਵੀ ਹੈਗੀ ਆ ਤਾਂ ਮੈਂ ਤੈਨੂੰ ਸਭ ਤੋਂ ਪਹਿਲੀ ਜਿਹੜੀ ਤੇਰੀ ਚੋਇਸ ਹੈ ਇਹੀ ਕਹੂੰਗਾ ਕਿ ਤੂੰ ਐੱਲ ਆਈ ਸੀ ਨੂੰ ਜ਼ਿਆਦਾ ਸਾਹਮਣੇ ਰੱਖ ਕੇ ਤੂੰ ਐੱਲ ਆਈ ਸੀ ਤੋਂ ਹੀ ਆਪਣੀ ਜਿਹੜੀ ਬੀਮਾ ਜਿਹੜੀ ਕਰਵਾਉਣੀ ਹੈ ਉਹ ਜ਼ਿਆਦਾ ਵਧੀਆ ਹੈ ਅਤੇ ਉਹਨਾਂ ਦਾ ਜਿਹੜਾ ਸਟਾਫ ਆ ਉੱਥੇ ਉਹ ਵੀ ਬੜਾ ਹੀ ਵਧੀਆ ਤਰੀਕੇ ਨਾਲ ਟਰੀਟ ਕਰਦਾ ਹੈ ਬੰਦੇ ਨੂੰ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੰਪਨੀਆਂ ਨੇ ਜਿਵੇਂ ਕਿ ਤੈਨੂੰ ਪਤਾ ਐ ਬਜਾਜ ਰਲਾਇੰਸ ਦੀ ਬਜਾਜ ਅਲਾ ਅਲਾਇੰਸ ਦੀ ਸੁਣੀ ਹੋਣੀ ਇਸ ਤੋਂ ਇਲਾਵਾ ਅਧੀਤਿਆ ਬਿਰਲਾ ਵਾਲਿਆਂ ਦੀ ਕੰਪਨੀ ਹੈ ਉਹ ਵੀ ਅੱਜ ਕੱਲ੍ਹ ਬੜੀ ਵਧੀਆ ਕੰਪਨੀ ਹੈ ਅਤੇ ਬਸ ਆਹੀ ਤਿੰਨ ਚਾਰ ਨੇ ਮੇਨ ਕੰਪਨੀਆਂ ਜਿਹਨਾਂ ਤੋਂ ਦੇਖ ਕੇ ਕਰ ਸਕਦਾ ਹੈ ਇਸ ਤੋਂ ਇਲਾਵਾ ਤਾਂ ਹੋਰ ਕੋਈ ਕੰਪਨੀ ਨਹੀਂ ਹੈ ਪਰ ਇਹੀ ਹੈ ਕਿ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਪ੍ਰੀਮੀਅਮ ਦੇਖ ਕੇ ਉਸ ਕੰਪਨੀ ਨੂੰ ਚੂਜ ਕਰੀ ਜਿਹੜੀ ਤੈਨੂੰ ਠੀਕ ਲੱਗੇ ਠੀਕ ਹੈ ਇਸ ਤੋਂ ਵੱਧ ਤਾਂ ਮੈਂ ਤੈਨੂੰ ਹੋਰ ਕੋਈ ਸਜੈਸ਼ਨ ਤਾਂ ਹੋਰ ਕੀ ਬਾਕੀ ਤੂੰ ਦੱਸ ਦੇ ਮੈਨੂੰ ਵੀ ਤੇਰੇ ਕੋਲ ਕੋਈ ਸਪੈਸਫਿਕ ਅਤੇ ਨਾ ਕੋਈ ਕੁਸ਼ਚਨ ਹੈ ਗਾ ਪੁੱਛਣਾ ਹੈ ਤਾਂ ਉਹ ਪੁੱਛ ਸਕਦਾ ਹੈ ਮੈਂ ਉਸ ਹਿਸਾਬ ਨਾਲ ਤੈਨੂੰ ਫਿਰ ਜਵਾਬ ਦੇ ਦੂੰਗਾ